ਹੈਲੋ ਨਮਸਕਾਰ ਜੀ

ਦੇਖੋ ਪੰਜਾਬੀ ਜੁੱਤੀ ਅਤੇ ਫੁਲਕਾਰੀ ਚੁੰਨੀ ਤਾਂ ਬਹੁਤ ਜ਼ਿਆਦਾ ਮਸ਼ਹੂਰ ਹੈ ਇੱਥੇ ਦੀ ਤੁਸੀਂ ਇਦਾਂ ਕਰੋ ਗੋਲਡਨ ਟੈਂਪਲ ਦੇ ਕੋਲ ਮਾਰਕੀਟ ਹੈ ਸ਼ਹੀਦਾਂ ਦੇ ਕੋਲ ਮਾਰਕੀਟ ਹੈ ਹਾਰ ਗੇਟ ਚਲ ਜਾਓ ਤੁਸੀਂ ਉੱਥੇ ਵੀ ਬਹੁਤ ਜ਼ਿਆਦਾ ਵਧੀਆ ਚੀਜ਼ਾਂ ਤੁਹਾਨੂੰ ਮਿਲ ਜਾਣਗੀਆਂ ਪਰ ਇੱਦਾਂ ਕਰੋ ਤੁਸੀਂ ਨਾ ਦਰਬਾਰ ਸਾਹਿਬ ਦੇ ਕੋਲ ਜਿਹੜੀ ਮਾਰਕੀਟ ਹੈ ਨਾ ਉੱਥੇ ਜਾਓ ਤੁਹਾਨੂੰ ਨਾਲੇ ਵਧੀਆ ਚੀਜ਼ ਮਿਲ ਜਾਏਗੀ ਨਾਲੇ ਤੁਸੀਂ ਉੱਥੇ ਬਾਬਾ ਜੀ ਦੇ ਦਰਸ਼ਨ ਕਰ ਲਓਗੇ ਜੇ ਤੂੰ ਤੁਹਾਨੂੰ ਔਖਾ ਲੱਗਦਾ ਪਿਆ ਤਾਂ ਮੈਂ ਤੁਹਾਡੇ ਨਾਲ ਜਾਣ ਨੂੰ ਤਿਆਰ ਹੈ ਤੁਸੀਂ ਮੈਨੂੰ ਫੋਨ ਕਰ ਦਿਓ ਮੈਂ ਤੁਹਾਡੇ ਕੋਲ ਆ ਜਾਂਗੀ ਠੀਕ ਹੈ ਧੰਨਵਾਦ ਜੀ